ਹੈਲੋ ਸਤਿ ਸ਼੍ਰੀ ਅਕਾਲ ਸਰ ਮੈਂ ਸੁਰਜੀਤ ਕੁਮਾਰ ਜੋ ਕਿ ਪਠਾਨਕੋਟ ਤੋਂ ਬੋਲ ਰਿਹਾ ਹਾਂ ਜਿਵੇਂ ਕਿ ਤੁਸੀਂ ਪੁੱਛਿਆ ਹੈ ਕਿ ਬਾਗ ਵਿੱਚ ਬਾਗ ਵਿੱਚ ਪੰਛੀਆਂ ਨੂੰ ਆਕਰਸ਼ਿਤ ਕਰਨ ਲਈ ਕੀ ਕਰਨਾ ਚਾਹੀਦਾ ਹੈ ਬਾਗ ਬਗੀਚਿਆਂ ਵਿੱਚ ਸਾਨੂੰ ਇੱਕ ਨੰਬਰ 'ਤੇ ਤਾਂ ਆਪਣੇ ਘਰ ਦੀ ਬਾਹਰ ਦੀ ਗੈਲਰੀ ਵਿੱਚ ਛੋਟੇ ਛੋਟੇ ਗਮਲੇ ਰੱਖਣੇ ਚਾਹੀਦੇ ਹੈ ਤਾਂ ਕਿ ਉਸ ਵਿੱਚ ਅਸੀਂ ਅਲੱਗ ਅਲੱਗ ਦੇ ਫੁੱਲਾਂ ਦੇ ਪੌਦੇ ਲਗਾ ਸਕੀਏ ਅਤੇ ਸਾਨੂੰ ਜੋ ਕਿ ਪੰਛੀ ਫੁੱਲਾਂ ਨੂੰ ਦੇਖ ਕੇ ਉਸ 'ਤੇ ਬੈਠ ਸਕਣ ਨਾਲ ਕਿ ਸਾਨੂੰ ਸਾਡੇ ਘਰ ਦੀ ਬਾਹਰ ਦੀ ਗੈਲਰੀ ਨੂੰ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਕਿ ਪੰਛੀ ਉਸ 'ਤੇ ਆ ਕੇ ਆਪਣੇ ਘੋਂਸਲੇ ਬਣਾ ਸਕਣ ਹੋਰ ਕਿ ਸਾਨੂੰ ਆਪਣੀ ਗੈਲਰੀ ਅਤੇ ਪਾਣੀ ਪਾਣੀ ਦੇ ਪਿਆਲੇ ਵੀ ਰੱਖਣੇ ਚਾਹੀਦੇ ਹੈ ਕਿ ਤਾਂ ਕਿ ਉਹ ਘੋਂਸਲਾ ਬਣਾ ਕੇ ਇੱਥੇ ਲਾਗੇ ਹੀ ਪਾਣੀ ਪੀ ਸਕਣ ਨਾਲ ਕਿ ਸਾਨੂੰ ਉਸਨੇ ਦੇ ਖਾਣੇ ਲਈ ਜਿੱਦਾਂ ਜਵਾਰ ਕਣਕ ਦੇ ਆਦਿ ਦੇ ਆਦਿ ਅਨਾਜ ਰੱਖਣਾ ਚਾਹੀਦਾ ਹੈ ਤਾਂ ਕਿ ਉਹ ਖਾ ਸਕਣ ਅਤੇ ਆਪਣੀ ਭੁੱਖ ਪੂਰੀ ਕਰ ਸਕਣ ਇੱਦਾਂ ਦੀ ਸਾਨੂੰ ਪੰਛੀਆਂ ਲਈ ਕਰਨਾ ਚਾਹੀਦਾ ਹੈ